ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਆ ਇਹ ਗੁਰੂ ਰਾਮਦਾਸ ਜੀ ਨੇ ਇਹ ਵਸਾਇਆ ਏ ਨਗਰ ਅਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਜਾਓ ਅਤੇ ਨਗਰ ਵਸਾਓ ਅਤੇ ਗੁਰੂ ਰਾਮਦਾਸ ਜੀ ਨੇ ਇੱਥੇ ਆਣ ਕੇ ਨਗਰ ਵਸਾਇਆ ਸੀਗਾ ਅਤੇ ਜਦੋਂ ਇਹ ਨਗਰ ਵਸਾਇਆ ਤਾਂ ਉਸ ਵੇਲੇ ਇੱਥੇ ਬਵੰਜਾ ਕਿੱਤਿਆਂ ਦੇ ਵੱਖ ਵੱਖ ਲੋਕ ਲਿਆ ਕੇ ਵਸਾਏ ਜਿਹਦੇ ਨਾਲ ਇੱਥੋਂ ਦੀ ਜਿਹੜੀ ਆ ਵਪਾਰ ਦਾ ਜਿਹੜਾ ਇੱਕ ਸਿਸਟਮ ਉਹ ਚੱਲਿਆ ਫਿਰ ਇੱਥੇ ਗੁਰੂ ਸਾਹਿਬ ਜੀ ਨੇ ਸਰੋਵਰ ਦੀ ਖੁਦਵਾਈ ਕਰਕੇ ਸਰੋਵਰ ਬਣਵਾਇਆ ਅਤੇ ਇਹ ਧਾਰਮਿਕ ਕੇਂਦਰ ਜਿਹੜਾ ਸਿੱਖਾਂ ਦਾ ਉਹਦੇ ਰੂਪ ਦੇ ਵਿੱਚ ਹੋਂਦ ਦੇ ਵਿੱਚ ਆਇਆ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਥੇ ਆਣ ਕੇ ਮਹੱਤਵਪੂਰਨ ਕਾਰਜ ਕੀਤੇ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕੀਤੀ ਸਰੋਵਰ ਦੀ ਜਿਹੜੀ ਰਹਿੰਦੇ ਕਾਰਜ ਸੀਗੇ ਉਹ ਕੀਤੇ ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਿਆਈ ਪ੍ਰਾਪਤ ਕਰਨ ਤੋਂ ਬਾਅਦ ਇੱਥੇ ਆਣ ਕੇ ਟਿਕਾਣਾ ਕਰਕੇ ਇਹਨੂੰ ਸਿੱਖੀ ਦੇ ਕੇਂਦਰ ਵਜੋਂ ਸਥਾਪਿਤ ਕੀਤਾ ਇੱਥੇ ਫਿਰ ਬਾਅਦ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰਕੇ ਸਾਹਮਣੇ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਸੋ ਇਹ ਇਸ ਸਮੇਂ ਦੇ ਵਿੱਚ ਸਿੱਖਾਂ ਦਾ ਮਹੱਤਵਪੂਰਨ ਕੇਂਦਰੀ ਸਥਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਇੱਥੇ ਵੱਖ ਵੱਖ ਗੁਰੂ ਸਾਹਿਬਾਨ ਨੇ ਚਰਨ ਵੀ ਪਾਏ ਸੋ ਆਪ ਜੀ ਇੱਥੇ ਆਇਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਗੁਰੂ ਸਾਹਿਬ ਕਿਰਪਾ ਕਰਨ ਠੀਕ ਹੈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ